ਵਾਕਿਆ ਹੀ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਕਿਉਂਕਿ ਹਰ ਜਗ੍ਹਾ 'ਤੇ ਮੀਡੀਆ ਹੀ ਕੰਮ ਕਰਦਾ ਹੈ ਮੀਡੀਆ ਨਹੀਂ ਹੋਵੇਗਾ ਤਾਂ ਦੇਸ਼ ਵਿਦੇਸ਼ ਮੇਂ ਕਿਤੇ ਵੀ ਖ਼ਬਰਾਂ ਵੀਡੀਓ ਕਿਰਕਟ ਆਦਿ ਕੁਛ ਦਾਰਮਿਕ ਪ੍ਰੋਗਰਾਮ ਕੁਛ ਵੀ ਦਿਖਾਈ ਨਹੀਂ ਦੇ ਸਕਦਾ ਮੀਡੀਆ ਆਣੇ ਪਰ ਲੋਗੋਂ ਮੇਂ ਬਹੁਤ ਤਰ੍ਹਾਂ ਕੇ ਬਹੁਤ ਤਰ੍ਹਾਂ ਦੇ ਖੌਫ਼ ਖਤਮ ਹੋ ਗਏ ਹਨ ਇਸ ਕਰਕੇ ਮੀਡੀਆ ਮਿੰਟਾਂ ਮੇਂ ਸਭ ਕਾਮ ਦੇਖ ਰਹਾ ਹੈ ਇਸ ਕਰਕੇ ਸਭ ਨੂੰ ਮੀਡੀਆ ਤੋਂ ਬਚਣ ਵਾਸਤੇ ਬਹੁਤ ਕੁਛ ਦੇਖਣਾ ਪੜਤਾ ਹੈ ਧੰਨਵਾਦ